ਪੇਂਟਿੰਗ ਇੱਕ ਉਹ ਕਲਾ ਹੈਗੀ ਆ ਜਿਹਦੇ ਵਿੱਚ ਆਪਾਂ ਅਲੱਗ ਅਲੱਗ ਕਲਾਵਾਂ ਨੂੰ ਪ੍ਰਸਤੁਤ ਕਰ ਸਕਦੇ ਹਾਂ ਸੰਗੀਤ ਹੋਵੇ ਜਾਂ ਫਿਰ ਨਾਚ ਗਾਨ ਹੋਵੇ ਆਪਾਂ ਪੇਂਟਿੰਗ ਰਾਹੀਂ ਹੀ ਆਪਣੇ ਕਲਾਵਾਂ ਦੇ ਸਹਿਤ ਉਹਨੂੰ ਸ਼ਾਮਿਲ ਕਰ ਸਕਦੇ ਹਾਂ ਪੇਂਟਿੰਗ ਕਰਨ ਦੇ ਨਾਲ ਆਪਾਂ ਆਪਣੇ ਅੰਦਰੂਨੀ ਭਾਵਾਂ ਨੂੰ ਪ੍ਰਸਤੁਤ ਕਰ ਸਕਦੇ ਹਾਂ ਇਹ ਉਹ ਸਮਾਂ ਸੀਗਾ ਜਦੋਂ ਮੈਂ ਪੜਦੀ ਹੁੰਦੀ ਸੀਗੀ ਤੇ ਆਪਣੀ ਕਲਾਵਾਂ ਦੇ ਅਨੁਸਾਰ ਪੇਂਟਿੰਗ ਰਾਹੀਂ ਹੀ ਆਪਣੇ ਦੁੱਖ ਸੰਗੀਤ ਨੂੰ ਪ੍ਰਸਤੂਤ ਕਰਦੀ ਹੁੰਦੀ ਸੀ ਮੈਂ ਇਹ ਪੇਂਟਿੰਗ ਉਦੋਂ ਬਣਾਈ ਸੀਗੀ ਜਦੋਂ ਮੈਂ ਛੇਵੀਂ ਕਲਾਸ 'ਚ ਸੀਗੀ ਤੇ ਉਹਦੇ ਵਿੱਚ ਮੈਂ ਆਪਣੇ ਸੰਗੀਤ ਰਾਹੀਂ ਪੇਂਟਿੰਗ ਦੇ ਵਿੱਚ ਦੱਸਿਆ ਸੀਗਾ ਕੀ ਪੇਂਟਿੰਗ ਜਾਂ ਸੰਗੀਤ ਦੋਨੋਂ ਹੀ ਕਲਾ ਹੈ ਜੋ ਕੱਠੀ ਰਹਿ ਕੇ ਹੀ ਬਣਦੀ ਹੈ ਪੇਂਟਿੰਗ ਸੰਗੀਤ ਨਾਲੋਂ ਅਧੂਰੀ ਹੈ ਤੇ ਸੰਗੀਤ ਪੇਂਟਿੰਗ ਨਾਲੋਂ ਅਧੂਰਾ ਹੈਗਾ ਇਹ ਸੰਗੀਤ ਹੀ ਹੈਗਾ ਜੋ ਪੇਂਟਿੰਗ ਨੂੰ ਸੁੰਦਰ ਰੂਪ ਦਿੰਦਾ ਹੈਗਾ ਵੈ ਤੇ ਪੇਂਟਿੰਗ ਹੀ ਹੈਗੀ ਹੈ ਜੋ ਸੰਗੀਤ ਨੂੰ ਸੁੰਦਰ ਰੂਪ ਦਿੰਦੀ ਹੈ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਨਵਾਂ ਟਰੈਂਡ ਸ਼ੁਰੂ ਹੋਇਆ ਵੈ ਤੇ ਲੋਕੀ ਪੇਂਟਿੰਗ ਵਿੱਚ ਹੀ ਸੰਗੀਤ ਦੀ ਇਨੋਵੇਸ਼ਨ ਕਰਦੇ ਹਾਂ ਉਹਦੇ ਰਾਹੀਂ ਆਪਣੀ ਕਲਾ ਨੂੰ ਪ੍ਰਸਤੁਤ ਕਰਦੇ ਹਾਂ ਮੈਂ ਵੱਖ ਵੱਖ ਕਲਾਵਾਂ ਦੇ ਨਾਲ ਆਪਣੀ ਪੇਂਟਿੰਗ ਨੂੰ ਲੋਕਾਂ ਸਾਹਮਣੇ ਰੱਖਦੀ ਸੀ ਜਿਸ ਕਰਕੇ ਮੈਂ ਉਹਨਾਂ ਨੂੰ ਦੱਸ ਸਕਾ ਕਿ ਮੇਰੇ ਪੇਂਟਿੰਗ ਕਿੰਨੀ ਵਧੀਆ ਹੈਗੀ ਹੈ ਤੇ ਉਹ ਆਪਣੇ ਵਾਤਾਵਰਣ ਨੂੰ ਪ੍ਰਸਤੁਹਿਤ ਕਰਦੀ ਸੀ ਇਹ ਕਲਾ ਮੈਨੂੰ ਮੇਰੇ ਅਧਿਕਾ ਅਧਿਆਪਿਕਾ ਨੇ ਦਿੱਤੀ ਸੀਗੀ ਕਿ ਉਹਨਾਂ ਨੇ ਕਿਹਾ ਸੀ ਜੋ ਚੀਜ਼ ਆਪਾਂ ਕਹਿ ਕੇ ਨਹੀਂ ਦੱਸ ਸਕਦੇ ਉਹ ਚੀਜ਼ ਆਪਾਂ ਸੰਗੀਤ ਰਾਹੀਂ ਜਾਂ ਫਿਰ ਪੇਂਟਿੰਗ ਰਾਹੀਂ ਕਹਿ ਸਕਦੇ ਹਾਂ ਜਿਸ ਕਰਕੇ ਮੈਂ ਆਪਣੀ ਕਲਾਵਾਂ ਨੂੰ ਔਰ ਪ੍ਰਸਾਹਿਤ ਕਰਨਾ ਚਾਹੁੰਦੀ ਸੀ ਆਪਣੀ ਪੇਂਟਿੰਗ ਵਿੱਚ ਵੱਖ ਵੱਖ ਕਿਸਮਾਂ ਦੀ ਕਲਾਮਾਂ ਨੂੰ ਜੋੜਿਆ ਸੀ ਤੇ ਉਹਨੂੰ ਅੱਗੇ ਪ੍ਰਸਾਹਿਤ ਕਰਨਾ ਚਾਹੁੰਦੀ ਸੀ ਕਿਸੇ ਵੀ ਚੀਜ਼ ਨੂੰ ਅਗਰ ਕਿਸੇ ਸਾਮਣੇ ਪ੍ਰਸਥਿਤ ਕਰਨਾ ਹੋਵੇ ਤੇ ਉਹ ਪੇਂਟਿੰਗ ਰਾਹੀਂ ਜਾਂ ਸੰਗੀਤ ਰਾਹੀ ਆਪਾਂ ਕਰ ਸਕਦੇ ਹਾਂ